ਮੈਂ ਇੱਕ ਸਮਾਰਟਫੋਨ ਖਰੀਦਿਆ ਸੀ ਜਿਸ ਦੀ ਹਾਲਤ ਬਹੁਤ ਬੁਰੀ ਸੀ ਜਦੋਂ ਮੈਂ ਉਸਦੀ ਪੈਕਿੰਗ ਬਾਰੇ ਦੇਖਿਆ ਤਾਂ ਇੱਕ ਦਮ ਖਸਤਾ ਹਾਲਤ ਦੇ ਵਿੱਚ ਮੈਨੂੰ ਮਿਲਿਆ ਉਸ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਮੇਰ ਜਦ ਮੈਂ ਸਮਾਰਟਫੋਨ ਨੂੰ ਉਸ ਪੈਕਿੰਗ ਦੇ ਵਿੱਚੋਂ ਬਾਹਰ ਕੱਢਿਆ ਤਾਂ ਮੇਰੇ ਸਮਾਰਟਫੋਨ ਦੀ ਹਾਲਤ ਵੀ ਬਹੁਤ ਬੁਰੀ ਤਰ੍ਹਾਂ ਸੀ ਮੇਰੇ ਸਮਾਰਟਫੋਨ ਦੇ ਨਾਲ ਹੋਰ ਵੀ ਜੋ ਚਾਰਜਰ ਵਗੈਰਾ ਆਇਆ ਸੀ ਉਹ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਮੇਰੇ ਫੋਨ ਦੀ ਸਕਰੀਨ ਬਹੁਤ ਬੁਰੀ ਤਰ੍ਹਾਂ ਸੀ ਮੈਂ ਜਿਸ ਉਮੀਦ ਨਾਲ ਫੋਨ ਖਰੀਦਿਆ ਸੀ ਉਸ ਉਮੀਦ 'ਤੇ ਕੰਪਨੀ ਨਹੀਂ ਉਤਰੀ ਇਸ ਕਾਰਣ ਮੈਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ